ਹਾਂਜੀ ਨਹੀਂ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ ਕਿਉਂਕਿ ਪੰਜਾਬੀ ਸਭ ਤੋਂ ਇਜ਼ ਲ ਸੌਖੀ ਲੈਂਗੁਏਜ ਹੈ ਇਹਨੂੰ ਬੋਲਣਾ ਅਤੇ ਲਿਖਣ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ ਪੰਜਾਬੀ ਲਿਖਣ ਦੇ ਵਿੱਚ ਬਹੁਤ ਸੌਖੀ ਹੁੰਦੀ ਹੈ ਕਿਉਂਕਿ ਇਹ ਪਹਿਲਾਂ ਵਾਲੇ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਮਾਤ ਭਾਸ਼ਾ ਸਿਖਾਈ ਜਾਂਦੀ ਸੀ ਆਪਣੀ ਪੰਜਾਬੀ ਆਪਣੀ ਮਾਤ ਭਾਸ਼ਾ ਆਪਣੀ ਮਾਤ ਭਾਸ਼ਾ ਲਿਖਣਾ ਲਿਖਣ ਜਾਂ ਬੋਲਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਪੰਜਾਬੀ ਲੈਂਗੁਏਜ਼ ਯੂਸ ਕਰਦੇ ਹਾਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਅਸੀਂ ਮਾਤ ਭਾਸ਼ਾ ਸਿਖਾਉਂਦੇ ਹਾਂ ਮਾਤ ਭਾਸ਼ਾ ਦੇ ਵਿੱਚ ਲਿਖਣਾ ਸਿਖਾਉਂਦੇ ਹਾਂ ਬੋਲਣਾ ਸਿਖਾਉਂਦੇ ਹਾਂ